ਮੈਂ ਰਾਜਕੁਮਾਰ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਜਿਵੇਂ ਕਿ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕੀ ਹੁੰਦਾ ਸੀ ਅਤੇ ਉਸਨੂੰ ਕਿਵੇਂ ਅਸੀਂ ਹੱਲ ਕਰ ਸਕਦੇ ਹਾਂ ਜਿਵੇਂ ਕਿ ਪਹਿਲੇ ਦੇ ਯੁੱਗ ਵਿੱਚ ਚਿੱਠੀ ਰਾਹੀਂ ਅਤੇ ਸੰਦੇਸ਼ ਭੇਜਦੇ ਸਾਂ ਉਸ ਤੋਂ ਬਾਅਦ ਬਟਨਾਂ ਵਾਲਾ ਫੋਨ ਆ ਗਿਆ ਅਤੇ ਆਮ ਲੋਕ ਆਸਤਾ ਆਸਤਾ ਉਸਨੂੰ ਕਰਨਾ ਇਸਤੇਮਾਲ ਕਰਨਾ ਸਿੱਖ ਗਏ ਪਰ ਜੇਕਰ ਅੱਜ ਦੇ ਸਮੇਂ 'ਚ ਦੇਖੀਏ ਤਾਂ ਜਿਵੇਂ ਕਿ ਉਸ ਤੋਂ ਬਾਅਦ ਟੱਚ ਫੋਨ ਆ ਗਿਆ ਉਸ ਬਾਰੇ ਪੁਰਾਣੇ ਬਜ਼ੁਰਗਾਂ ਜਾਂ ਪਿਆਣੇ ਸਮੇਂ ਦੇ ਲੋਕਾਂ ਨੂੰ ਇਸ ਬਾਰੇ ਨੋਲੇਜ ਨਹੀਂ ਸੀ ਪਰ ਫਿਰ ਵੀ ਲੋਕਾਂ ਨੂੰ ਆਸਤਾ ਆਸਤਾ ਸਮਝਾ ਕੇ ਦੱਸ ਰਹੇ ਹਾਂ ਤਾਂ ਉਹ ਕੁਝ ਲੋਕ ਤਾਂ ਸਮਝ ਜਾਂਦੇ ਹਨ ਪਰ ਕੁਝ ਲੋਕ ਤਾਂ ਨਹੀਂ ਸਮਝਦੇ ਪਰ ਕਈ ਲੋਕ ਤਾਂ ਫੋਨ ਰੱਖਣਾ ਵੀ ਕੋਲ ਪਸੰਦ ਨਹੀਂ ਕਰਦੇ ਹਨ ਪਰ ਅੱਜ ਦੇ ਯੁੱਗ ਵਿੱਚ ਚੀਜ਼ਾਂ ਬਹੁਤ ਜ਼ਰੂਰੀ ਹੋ ਗਈਆਂ ਹਨ ਜਿਵੇਂ ਕਿ ਅਸੀਂ ਔਨਲਾਈਨ ਤਕਨੀਕ ਆ ਗਈ ਹੈ ਪਹਿਲੇ ਦੇ ਯੁੱਗ ਵਿੱਚ ਲੋਕ ਸਾਈਕਲ ਜਾਂ ਪੈਦਲ ਜਾਂਦੇ ਸਨ ਅੱਜ ਦੇ ਯੁੱਗ ਵਿੱਚ ਲੋਕ ਸਕੂਟੀ ਜਾਂ ਇਲੈਕਟਰੀਕਲ ਕਾਰਾਂ ਆ ਗਈਆਂ ਹਨ ਇਹਨਾਂ ਬਾਰੇ ਪੁਰਾਣੇ ਬਜ਼ੁਰਗ ਨੂੰ ਪਤਾ ਨਹੀਂ ਲੱਗਦਾ ਜੇ ਇੱਕ ਵਾਰ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਛੋਟੇ ਬੱਚੇ ਨੂੰ ਕੋਈ ਅੱਜ ਦੀ ਤਕਨੀਕ ਜਿਵੇਂ ਕਿ ਟੱਚ ਫੋਨ ਹੀ ਲੈ ਲਓ ਉਸ ਬਾਰੇ ਸਾਰੀ ਨੌਲੇਜ ਹੁੰਦੀ ਹੈ ਉਸ ਬਾਰੇ ਸਾਰਾ ਪਤਾ ਹੈ ਪੁਰਾਣੇ ਖਿਆਲਾਤ ਦੇ ਲੋਕਾਂ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਦੱਸ ਕੇ ਜਾਗਰੂਕ ਕਰ ਸਕਦੇ ਹਾਂ